ਤੈਰਾਕੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੈ ਤੈਰਾਕੀ ਕਰਨ ਨਾਲ ਸਰੀਰ ਨੂੰ ਮੋਟਾਪਾ ਨਹੀਂ ਆਉਂਦਾ ਸਾਹ ਸੌਖਾ ਆਉਂਦਾ ਰਹਿੰਦਾ ਅਤੇ ਤੈਰਾਕੀ ਸਿਹਤ ਸਿਹਤ ਲਈ ਬਹੁਤ ਲਾਭਦਾਇਕ ਹੁੰਦੀ ਹੈ ਤੈਰਾਕੀ ਕਰਨ ਨਾਲ ਸਾਡੇ ਫੇਫੜੇ ਵਗੈਰਾ ਸਾਹ ਸੌਖਾ ਆਉਂਦਾ ਜਾਂਦਾ ਸਹੀ ਰਹਿੰਦੇ